ਪਾਣੀ ਦੀ ਲੋੜ ਦਿਨ ਦੇ ਹਿਸਾਬ ਨਾਲ ਏ ਪੈਂਦੀ ਹੈ ਅਤੇ ਜਿੱਦਾਂ ਆਪਾਂ ਉਸ ਦਿਨ ਦੇ ਕੰਮ ਕਰਦੇ ਹਾਂ ਤਾਂ ਉਹਦੇ ਹਿਸਾਬ ਨਾਲ ਏ ਪਾਣੀ ਦੀ ਲੋੜ ਪੈਂਦੀ ਹੈ ਜੇ ਕਿਸੇ ਦਿਨ ਠੰਡ ਜਿਆਦਾ ਹੁੰਦੀ ਹੈ ਤਾਂ ਪਾਣੀ ਘੱਟ ਚਾਹੀਦਾ ਹੁੰਦਾ ਜੇ ਠੰਡ ਘੱਟ ਹੈ ਜਾਂ ਗਰਮੀ ਜ਼ਿਆਦਾ ਹੈ ਉਸ ਦਿਨ ਆਪਾਂ ਨੂੰ ਪਾਣੀ ਦੀ ਲੋੜ ਜ਼ਿਆਦਾ ਹੈ ਬਾਕੀ ਜਿਹੜਾ ਮਿਹਨਤ ਕਰਦਾ ਬੰਦਾ ਸਰੀਰਿਕ ਮਿਹਨਤ ਕਰਦਾ ਹੈ ਜਿਵੇਂ ਕਹੀ ਚਲਾਉਣਾ ਜਾਂ ਦੌੜਨਾ ਭੱਜਣਾ ਉਸ ਉਸ ਦਿਨ ਪਾਣੀ ਦੀ ਰਿਕੁਆਇਰਮੈਂਟ ਵੱਧ ਜਾਂਦੀ ਹੈ ਨਹੀਂ ਤਾਂ ਪਾਣੀ ਦੀ ਰਿਕੁਆਇਰਮੈਂਟ ਨੋਰਮਲ ਹੀ ਰਹਿੰਦੀ ਹੈ ਜਿੰਨਾ ਕੁ ਆਪਾਂ ਪੰਜ ਸੱਤ ਗਲਾਸ ਇੱਕ ਦਿਨ 'ਚ ਪੀ ਸਕਦੇ ਹਾਂ